ਹਾਂਜੀ ਜਿਵੇਂ ਕਿ ਸਾਨੂੰ ਪਤਾ ਹੀ ਹੈ ਪਹਿਲਾਂ ਸਾਰੇ ਲੋਕ ਹੱਥ ਹੱਥੀਂ ਕਿਰਤ ਕਰਦੇ ਸਨ ਹੱਥਾਂ ਨਾਲ ਕੰਮ ਕਰਦੇ ਸਨ ਪਰ ਅੱਜ ਕੱਲ੍ਹ ਟੈਕਨੋਲੋਜੀ ਨੇ ਸਾਰਾ ਕੁਝ ਬਦਲ ਕੇ ਰੱਖ ਦਿੱਤਾ ਹੈ ਅੱਜ ਕੱਲ੍ਹ ਜਿਹੜਾ ਵੀ ਕੰਮ ਕਰੋ ਉਸ ਵਿੱਚ ਟੈਕਨੋਲੋਜੀ ਕਿਤੇ ਨਾ ਕਿਤੇ ਆ ਹੀ ਜਾਂਦੀ ਹੈ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਅਸੀਂ ਜਿੰਨੇ ਵੀ ਕਿਰਿਆ ਕਰਮ ਕਰਦੇ ਹਾਂ ਉਸ ਵਿੱਚ ਕਿਤੇ ਨਾ ਕਿਤੇ ਟੈਕਨੋਲੋਜੀ ਦਾ ਪ੍ਰਭਾਵ ਹੁੰਦਾ ਹੀ ਹੈ ਅਤੇ ਟੈਕਨੋਲੋਜੀ ਵਰਤਦੇ ਹੀ ਹਾਂ ਹੁਣ ਜਿਵੇਂ ਕਿ ਸਾਡਾ ਹੀ ਲਾ ਲਓ ਅਸੀਂ ਪਹਿਲਾਂ ਜਿਵੇਂ ਸਾਡਾ ਕੰਮ ਕਰਦੇ ਸੀਗੇ ਸਾਡਾ ਹੁਣ ਵੀ ਕੰਮ ਹੈ ਅਸੀਂ ਅਲਮਾਰੀਆਂ ਬਣਾਉਂਦੇ ਹਾਂ ਅਲਮਾਰੀਆਂ ਬਣਾਉਣ ਦੀ ਪ੍ਰਕਿਰਿਆ ਇਸ ਤਰੀਕੇ ਨਾਲ ਹੁੰਦੀ ਹੈ ਪਹਿਲਾਂ ਚਾਦਰ ਨੂੰ ਕੱਟਣਾ ਪੈਂਦਾ ਹੈ ਚਾਦਰ ਨੂੰ ਮੁੜ ਮੁੜਾਈ ਕਰਨੀ ਪੈਂਦੀ ਹੈ ਫਿਰ ਚਾਦਰ ਨੂੰ ਆਪਸ 'ਚ ਜੋੜਨਾ ਪੈਂਦਾ ਹੈ ਫਿਰ ਇੱਕ ਢਾਂਚਾ ਖੜ੍ਹਾ ਹੁੰਦਾ ਅਲਮਾਰੀ ਦਾ ਫਿਰ ਉਹਨੂੰ ਸਾਫ ਕਰਨਾ ਪੈਂਦਾ ਹੈ ਫਿਰ ਉਹਨੂੰ ਰੰਗ ਕਰਨਾ ਪੈਂਦਾ ਹੈ ਫਿਰ ਉਹਨੇ ਐਂਡ ਥਾ ਐਂਡ 'ਤੇ ਜਾ ਕੇ ਫਿਰ ਰੰਗ ਕਰਨਾ ਪੈਂਦਾ ਹੈ ਫਿਰ ਕਿਤੇ ਜਾ ਕੇ ਅਲਮਾਰੀ ਤਿਆਰ ਹੁੰਦੀ ਹੈ ਹੁਣ ਅਸੀਂ ਪਹਿਲਾਂ ਸਾਰਾ ਕਿਰਿਆ ਕਰਮ ਹੱਥੀਂ ਸਾਡੇ ਮਜ਼ਦੂਰ ਹੱਥੀਂ ਕਿਰਤ ਕਰਦੇ ਸਨ ਪਰ ਅੱਜ ਕੱਲ੍ਹ ਟੈਕਨੋਲੋਜੀ ਨੇ ਸਾਰਾ ਕੁਝ ਚੇਂਜ ਕਰ ਦਿੱਤਾ ਹੈ ਅਸੀਂ ਹੁਣ ਮਸ਼ੀਨਾਂ ਵਰਤਣ ਲੱਗ ਪਏ ਹਾਂ ਅਸੀਂ ਰੰਗ ਕਰਨ ਵਾਸਤੇ ਮਸ਼ ਮਸ਼ੀਨਾਂ ਰੱਖੀਆਂ ਹੋਈਆਂ ਅਸੀਂ ਮੁੜਾਈ ਕਰਨ ਵਾਸਤੇ ਕਟਾਈ ਕਰਨ ਵਾਸਤੇ ਆਪਸ ਵਿੱਚ ਜੋੜਨ ਵਾਸਤੇ ਜਦੋਂ ਚਾਦਰਾਂ ਨੂੰ ਸਾਰਿਆਂ ਨੂੰ ਵੱਖਰੀਆਂ ਵੱਖਰੀਆਂ ਮਸ਼ੀਨਾਂ ਰੱਖੀਆਂ ਹੋਈਆਂ ਹਨ ਮਸ਼ੀਨਾਂ 'ਚ ਪਾਓ ਸਾਡਾ ਸਮਾਨ ਤਿਆਰ ਹੋ ਜਾਂਦਾ ਹੈ ਜਿਵੇਂ ਅਸੀਂ ਚਾਦਰ ਪਾਉਂਦੇ ਹਾਂ ਸਾਡੀ ਅਲਮਾਰੀ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਨਾਲ ਸਾਡਾ ਬਹੁਤ ਹੀ ਫਾਇਦਾ ਵੀ ਹੋਇਆ ਹੈ ਫਾਇਦਾ ਹੀ ਹੋਇਆ ਨੁਕਸਾਨ ਤਾਂ ਬਹੁਤ ਘੱਟ ਹੁੰਦਾ ਹੈ ਫਾਇਦਾ ਇਸ ਤ ਤਰੀਕੇ ਨਾਲ ਹੈ ਪਹਿਲਾਂ ਤਾਂ ਸਾਡਾ ਸਮਾਂ ਬਹੁਤ ਬਚ ਜਾਂਦਾ ਹੈ ਜਿੱਥੇ ਸਾਨੂੰ ਕਾਫੀ ਦੋ ਦੋ ਤਿੰਨ ਦਿਨ ਲੱਗ ਜਾਂਦੇ ਸਨ ਇੱਕ ਅਲਮਾਰੀ ਤਿਆਰ ਹੁੰਦੇ ਅੱਜ ਉਹ ਇੱਕ ਦਿਨ 'ਚ ਅਸੀਂ ਤਿੰਨ ਤਿੰਨ ਅਲਮਾਰੀਆਂ ਤਿਆਰ ਕਰ ਦਿੰਦੇ ਹਾਂ ਇਸ ਨਾਲ ਸਾਫ ਸਫਾਈ ਬਹੁਤ ਹੁੰਦੀ ਹੈ ਬਹੁਤ ਵਧੀਆ ਤਰੀਕੇ ਨਾਲ ਅਲਮਾਰੀ ਤਿਆਰ ਹੁੰਦੀ ਹੈ ਜਿਸ ਨਾਲ ਸਾਡਾ ਗਾਹਕ ਵੀ ਖੁਸ਼ ਹੁੰਦਾ ਹੈ ਅਖੀਰ ਵਿੱਚ ਮੈਂ ਆਹੀ ਕਹਿਣਾ ਚਾਹੂੰਗਾ ਕਿ ਜਿਹੜਾ ਮਰਜ਼ੀ ਕੰਮ ਕਰੀਏ ਅੱਜ ਕੱਲ੍ਹ ਟੈਕਨੋਲੋਜੀ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ